ਹਾਂਜੀ ਗੁਗਲੀ ਕੌਮਿਕਸ ਇੰਨੀ ਵਧੀਆ ਹੈ ਮੀਨਜ਼ ਤੁਸੀਂ ਸੋਚ ਹੀ ਨਹੀਂ ਸਕਦੇ ਉਹਦੇ ਵਿੱਚ ਜਦੋਂ ਪੜ੍ਹਦੇ ਹੋ ਇੱਦਾਂ ਦੇ ਕੰਮ ਹਮੇਸ਼ਾ ਕਰਦੀ ਰਹਿੰਦੀ ਹੈ ਉਲਟੇ ਸਿੱਧੇ ਵੀ ਕਰਦੀ ਹੈ ਸਹੀ ਵੀ ਕਰਦੀ ਹੈ ਪਰ ਮੀਨਜ਼ ਹਮੇਸ਼ਾ ਉਲਟੇ ਕੰਮ ਜਦੋਂ ਵੀ ਉਲਟੇ ਕੰਮ ਕਰਦੀ ਉਹ ਹਮੇਸ਼ਾ ਸਿੱਧੇ ਹੀ ਹੋ ਜਾਂਦੇ ਆ ਮੀਨਜ਼ ਇਹ ਨਹੀਂ ਹੈਗਾ ਵੀ ਕਰਦੀ ਤਾਂ ਉਹਦੇ ਜਾਨੀ ਉਲਟੇ ਹੈ ਠੀਕ ਹੈ ਪਰ ਉਹ ਕੰਮ ਹਮੇਸ਼ਾ ਸਿੱਧਾ ਹੋ ਜਾਂਦਾ ਜਦੋਂ ਵੀ ਉਹ ਆਪਣੇ ਘਰ ਵਿੱਚ ਕੁਝ ਵੀ ਕਰਦੀ ਆ ਠੀਕ ਆ ਉਹਦੇ ਪੇਰੈਂਟਸ ਕਹਿੰਦੇ ਗੁਗਲੀ ਇਹ ਕੀ ਕਰਤਾ ਤੁਸੀਂ ਪਰ ਫਿਰ ਵੀ ਮੀਨਜ਼ ਕੁਛ ਵੀ ਕੰਮ ਕਰਤਾ ਘਰ ਦਾ ਜਾਂ ਕੁਛ ਵੀ ਉਲਟਾ ਫੁਲਟਾ ਕਰਤਾ ਠੀਕ ਹੈ ਉਹਦਾ ਕੰਮ ਹਮੇਸ਼ਾ ਸਿੱਧਾ ਹੁੰਦਾ ਠੀਕ ਹੈ ਮੀਨਜ਼ ਬਹੁਤ ਵਾਰ ਇੱਦਾਂ ਹੋਇਆ ਜੇ ਕੋਈ ਨੁਕਸਾਨ ਕਰਨ ਲੱਗਦੀ ਹੈ ਠੀਕ ਹੈ ਅਗਲੇ ਦਾ ਵਧੀਆ ਹੋ ਜਾਂਦਾ ਬਾਹਰ ਖੇਡਣ ਜਾਂਦੀ ਹੈ ਠੀਕ ਹੈ ਬਹੁਤ ਵਾਰ ਇੱਦਾਂ ਹੋਇਆ ਕਿ ਉਹਨਾਂ ਦਾ ਨੁਕਸਾਨ ਵੀ ਹੁੰਦਾ ਪੇਰੈਂਟਸ ਦਾ ਠੀਕ ਹੈ ਪਰ ਇੰਨੀ ਹਾਸੀ ਮਜ਼ਾਕ ਅਤੇ ਇੰਨੀ ਵਧੀਆ ਕੌਮੀਕਸ ਹੈ ਵਾਲੀ ਤੁਸੀਂ ਪੜ੍ਹੋਗੇ ਅਤੇ ਬੱਚਿਆਂ ਲਈ ਵੀ ਮੀਨਜ਼ ਬਹੁਤ ਹੀ ਜ਼ਿਆਦਾ ਵਧੀਆ ਹੈ ਉਹਦੇ 'ਚ ਬਹੁਤ ਸਾਰੀਆਂ ਸ਼ਿਕਸ਼ਾ ਵੀ ਮਿਲਦੀਆਂ ਠੀਕ ਹੈ ਸਿੱਖਣ ਨੂੰ ਵੀ ਮਿਲਦਾ ਬਹੁਤ ਕੁਛ ਪਤਾ ਵੀ ਲੱਗਦਾ ਵੀ ਹਾਂ ਨਹੀਂ ਯਾਰ ਬਾਕਏ ਬਹੁਤ ਮਜ਼ਾ ਆਉਂਦਾ ਅਤੇ ਜਦੋਂ ਤੁਸੀਂ ਪੜ੍ਹਦੇ ਹੋ ਇੱਕ ਵਾਰ ਤਾਂ ਦਿਮਾਗ ਇੰਨਾ ਫਰੈਸ਼ ਹੋ ਜਾਂਦਾ ਇੰਨਾ ਵਧੀਆ ਲੱਗਦਾ ਇੱਦਾਂ ਲੱਗਦਾ ਵੀ ਯਾਰ ਆਹਾ ਨਸ਼ਾ ਆ ਗਿਆ ਪੜ੍ਹ ਕੇ ਹੱਸ ਹੱਸ ਕੇ ਆਪਣੇ ਦਿਮਾਗ ਦੀਆਂ ਨਾੜਾਂ ਹੀ ਖੁੱਲ੍ਹ ਜਾਂਦੀਆਂ ਠੀਕ ਹੈ ਇੰਨਾ ਮਸਤ ਕੌਮੀਕਸ ਹੈ ਇੰਨੀ ਵਧੀਆਂ ਪੜ੍ਹਨੀ ਚਾਹੀਦੀ ਹੈ ਬੱਚਿਆਂ ਨੂੰ ਵੀ ਦੱਸਣੀ ਉਹਨਾਂ ਨੂੰ ਵੀ ਪਤਾ ਲੱਗੇ ਵਧੀਆ ਲੱਗੇ ਠੀਕ ਹੈ ਮੀਨਜ਼ ਉਹ ਕਰ ਸਕਣ ਇਹ ਕਰਨ ਵਧੀਆਂ ਹੋਵੇ ਉਹਨਾਂ ਲਈ ਠੀਕ ਹੈ ਛੋਟੀ ਛੋਟੀ ਕੌਮੀਕਸ ਪੜ੍ਹਨੀਆਂ ਬਹੁਤ ਜ਼ਰੂਰੀ ਹੈ ਅਤੇ ਇਹਨਾਂ ਕੋਮੀਕਸ ਦੇ ਵਿੱਚ ਬਹੁਤ ਸਾਰੀਆਂ ਸਿੱਖਿਆਵਾਂ ਵੀ ਮਿਲਦੀਆਂ ਠੀਕ ਹੈ ਵਧੀਆ ਰਚਨਾਤਮਕ ਕਈ ਕੰਮ ਕਰਨ ਦੇ ਤਰੀਕੇ ਵੀ ਤੁਹਾਨੂੰ ਮਿਲਦੇ ਹੈ ਹਾਂਜੀ